ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਸੱਭਿਆਚਾਰ ਦੀ ਪਹਿਚਾਣ ਅਤੇ ਕਿਸ ਤਰ੍ਹਾਂ ਜੋ ਪੰਜਾਬੀ ਦੀ ਭਾਸ਼ਾ ਦੇ ਨਾਲ ਆਪਣੇ ਅੱਜ ਕੱਲ੍ਹ ਦੀ ਆਉਣ ਵਾਲੀ ਪੀੜ੍ਹੀ ਹੈ ਉਹ ਇਸ ਤੋਂ ਵਾਂਝੀ ਹੋ ਰਹੀ ਹੈ ਆਪਾਂ ਜਿਵੇਂ ਕਿ ਆਪਾਂ ਸਾਰੇ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਆਪਾਂ ਜ਼ਿਆਦਾਤਰ ਪੰਜਾਬੀ ਭਾਸ਼ਾ ਹੀ ਬੋਲਦੇ ਹਾਂ ਅੱਜ ਪਰੰਤੂ ਅੱਜ ਕੱਲ੍ਹ ਦੇ ਜੋ ਬੱਚੇ ਨੇ ਉਹ ਪੰਜਾਬੀ ਭਾਸ਼ਾ ਬਹੁਤ ਘੱਟ ਬੋਲ ਰਹੇ ਨੇ ਕਿਉਂਕਿ ਇਸਦਾ ਮੇਨ ਕਾਰਨ ਇਹ ਵੀ ਹੈ ਕਿ ਉਹ ਮਾ ਮਾਤਾ ਪਿਤਾ ਜੋ ਬੱਚਿਆਂ ਦੇ ਉਹਨਾਂ ਨੂੰ ਆਈ ਸੀ ਐੱਸ ਈ ਸੀ ਬੀ ਐੱਸ ਈ ਪੈਟਰਨ ਸਕੂਲ ਵਿੱਚ ਹੀ ਪੜ੍ਹਾ ਰਹੇ ਨੇ ਜਿਸ ਕਰਕੇ ਉੱਥੇ ਸਿਰਫ ਹਿੰਦੀ ਅਤੇ ਇੰਗਲਿਸ਼ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਅਤੇ ਪੰਜਾਬੀ ਨੂੰ ਇੱਕ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਹੀ ਵਰਤਿਆ ਜਾ ਰਿਹਾ ਕਈ ਵਾਚ ਕਈ ਥਾਂ 'ਤੇ ਇਸਨੂੰ ਬਸ ਯੂਜ਼ ਹੀ ਨਹੀਂ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਜੋ ਆਪਣੇ ਬੱਚੇ ਆ ਜਿਸ ਕਰਕੇ ਉਹ ਪੰਜਾਬੀ ਬਹੁਤ ਘੱਟ ਬੋਲਦੇ ਆ ਆਪਾਂ ਘਰਾਂ ਵਿੱਚ ਵੀ ਪੰਜਾਬੀ ਦੀ ਥਾਂ 'ਤੇ ਬੱਚਿਆਂ ਨਾਲ ਹਿੰਦੀ ਵਿੱਚ ਗੱਲ ਕਰ ਰਹੇ ਹਾਂ ਜਾਂ ਇੰਗਲਿਸ਼ ਵਿੱਚ ਗੱਲ ਕਰ ਰਹੇ ਹਾਂ ਪਰੰਤੂ ਆਪਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਬੱਚਿਆਂ ਨੂੰ ਆਪਣੇ ਸਾਹਿਤ ਨਾਲ ਜੋੜੀਏ ਉਹਨਾਂ ਨੂੰ ਆਪਣੇ ਦੇਸ਼ ਭਗਤਾਂ ਬਾਰੇ ਗੁਰੂਆਂ ਬਾਰੇ ਦੱਸੀਏ ਅਤੇ ਆਪਣੇ ਪੰਜਾਬ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਈਏ ਅਤੇ ਉਹਨਾਂ ਨਾਲ ਜ਼ਿਆਦਾਤਰ ਪੰਜਾਬੀ ਵਿੱਚ ਹੀ ਗੱਲ ਕਰੀਏ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਸਿੱਖਣ ਲਈ ਉਤੇਜਿਤ ਕਰੀਏ ਜਿਸ ਨਾਲ ਉਹਨਾਂ ਦੀ ਪੰਜਾਬੀ ਭਾਸ਼ਾ ਹੋਰ ਵੀ ਵਧੀਆ ਹੋਵੇ ਅਤੇ ਆਪਾਂ ਨੇ ਆਉਣ ਵਾਲੇ ਜੋ ਪੀੜ੍ਹੀਆਂ ਨੇ ਪ ਪੰਜਾਬੀ ਭਾਸ਼ਾ ਤੋਂ ਵਾਂਝੀਆਂ ਨਾ ਰਹਿਣ ਧੰਨਵਾਦ